ਹੈਲੋ ਹਾਂਜੀ ਅ ਮੈਮ ਮੈਂ ਜੋਗਿੰਦਰ ਸਿੰਘ ਦਾ ਫਾਦਰ ਬੋਲ ਰਿਹਾ ਅਤੇ ਮੈਂ ਤੁਹਾਡੇ ਕੋਲ ਜਾਣਕਾਰੀ ਲੈਣੀ ਸੀ ਕਿ ਤੁਹਾਡੇ ਹੁਣੇ ਇਹ ਖੇਡਾਂ ਕਿਹੜੀਆਂ ਕਿਹੜੀਆਂ ਅਤੇ ਕਦੋਂ ਤੁਸੀਂ ਕਰਵਾ ਰਹੇ ਜੀ ਠੀਕ ਆ ਜੀ ਮੈ ਜੋਗਿੰਦਰ ਸਿੰਘ ਜੋਗਿੰਦਰ ਸਿੰਘ ਜੋਗਿੰਦਰ ਸਿੰਘ ਹੈ ਜੀ ਮੈਂ ਨਿਰਵੈਰ ਮੈਂ ਨਿਰਵੈਰ ਸਿੰਘ ਬੋਲ ਰਿਹਾ ਅਤੇ ਅਤੇ ਕਿਹੜੀਆਂ ਕਿਹੜੀਆਂ ਜੀ ਅਤੇ ਮੈਂ ਆਪਣੇ ਬੇਟੇ ਦਾ ਨਾਮ ਲਿਖਾਉਣਾ ਸੀ ਅਤੇ ਫਿਰ ਉਹ ਉਹ ਕਿਵੇਂ ਉਹ ਕਰ ਪਾਊਗਾ ਕਿ ਨਹੀਂ ਜੀ

ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਚਲੋ ਠੀਕ ਆ ਬਾਕੀ ਤੁਸੀਂ ਵੀ ਧਿਆਨ ਰੱਖਿਓ ਤੇ ਨਹੀਂ ਤੁਸੀਂ ਇ ਇਹ ਇਹ ਦੱਸਿਓ ਨਾ ਵੀ ਇਹ ਉਹ ਮਲਕੇ ਉਹ ਅ ਬੇਟਾ ਕਿਹੜੀ ਗੇਮ ਦੇ ਵਿੱਚ ਜ਼ਿਆਦਾ ਇੰਟਰਸਟਡ ਆ ਅਤੇ ਕਿਹੜੀ ਉਹ ਕਰ ਸਕਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਚਲੋ ਠੀਕ ਹੈ ਫਿਰ ਆਪਾਂ ਹਾਂਜੀ ਓਕੇ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਜੀ